ਸਤਿ ਸ਼੍ਰੀ ਅਕਾਲ ਸਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਯੋਗਾ ਸਾਡੇ ਬਹੁਤ ਜ਼ਰੂਰੀ ਹੈ ਯੋਗਾ ਯੋਗਾ ਸਾਡੇ ਲਈ ਬਹੁਤ ਜ਼ਰੂਰੀ ਹੈ ਯੋਗਾ ਦੇ ਕਾਰਨ ਸਾਡੇ ਜਿਹੜਾ ਸਰੀਰ ਆ ਉੱਥੇ ਤੰਦਰੁਸਤ ਬਣਦਾ ਹੈ ਮਤਲਬ ਯੋਗਾ ਦੇ ਕਾਰਨ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਅ ਜਿਹੜਾ ਯੋਗਾ ਆ ਉਹਦੇ ਕਾਰਨ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਿਵਾ ਜਿਵੇਂ ਕਿ ਉਹਨਾਂ ਪਹਿਲੇ ਅ ਮੇਰੇ ਮੰਮਾ ਪਾਪਾ ਵੀ ਯੋਗਾ ਕਰਦੇ ਹਨ ਉਨਾ ਉਹਨਾਂ ਨੂੰ ਸ਼ੁਰੂ ਸ਼ੁਰੂ 'ਚ ਬੜਾ ਸਾਰਾ ਉਹ ਹੁੰਦਾ ਬਟ ਉਹ ਹੁਣ ਉਹ ਉਹਦਾ ਟਾਈਮ ਟਾਈਮ ਸਿਰ ਯੋਗਾ ਕਰਨਾ ਉਹਨਾਂ ਦਾ ਮਤਲਬ ਜ਼ਿਆਦਾ ਰੱਬਦਾਰ ਰੱਬ ਵੱਲ ਧਿਆਨ ਬਣ ਗੇ ਦਾ ਆ ਅਤੇ ਉਹਦੇ ਜਿਹੜੀ ਕੰਸਟਰੇਸ਼ਨ ਉਹ ਬੜੀ ਹਾਈ ਲੈਵਲ ਦੀ ਹੋ ਗੇ ਦੀ ਹੈ ਅਤੇ ਹੁਣ ਮੈਂ ਮੈਂ ਹੁਣ ਫਿਰ ਮੈਂ ਵੀ ਹੁਣ ਯੋਗਾ ਕਰਦੀ ਹਾਂ ਜਿਹਦੇ ਕਾਰਨ ਮੇਰੀ ਜਿਹੜੀ ਕੰਸਟਰੇਸ਼ਨ ਆ ਉਹ ਮੇਰੀ ਸਟਡੀ ਵੱਲ ਹੀ ਹੁੰਦੀ ਹੋਰ ਕਿਤੇ ਹੋਰ ਕਿਸੇ ਨੈਗਟਿਵ ਥੋਟਸ ਜਾਂ ਪੋਜੀਟਿਵ ਥੋਟਸ ਵੱਲ ਨਹੀਂ ਜਾਂਦੀ ਅਤੇ ਹੁਣ ਮੈਂ ਸਿਰਫ਼ ਆਪਣੀ ਸਟਡੀ ਵੱਲ ਫੋਕਸ ਕਰ ਪਾਉਦੀ ਹਾਂ ਅਤੇ ਯੋਗਾ ਯੋਗਾ ਕਰਨ ਦੇ ਸਾਨੂੰ ਬਹੁਤ ਲਾਭ ਹੁੰਦੇ ਨੇ ਅਸੀਂ ਅਸੀਂ ਸਵੇਰੇ ਮਤਲਬ ਸਾਡਾ ਸਵੇਰੇ ਅ ਅਸੀਂ ਤੰਦਰੁਸਤ ਰਹਿੰਦੇ ਹਾਂ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਬਿ ਬਿਮਾਰੀ ਨਹੀਂ ਲੱਗਦੀ ਕੋਈ ਮਤਲਬ ਸਾਡੇ ਸਰੀਰ ਵੀ ਠੀਕ ਠਾਕ ਰਹਿੰਦਾ